ਹੈਲੋ ਮਿਸ਼ੋ ਤੋਂ ਗੱਲ ਕਰਦੇ ਹੋ ਮੈਂ ਤੁਹਾਡੇ ਐਪ ਤੋਂ ਪ੍ਰੋਡਕਟ ਮੰਗਵਾਇਆ ਸੀ ਜੋ ਕਿ ਮੈਨੂੰ ਚੰਗਾ ਨਹੀਂ ਲੱਗਿਆ ਚੰਗਾ ਨਹੀਂ ਨਿਕਲਿਆ ਪ੍ਰੋਡਕਟ ਦੇ ਵਿੱਚ ਕੁੜਤਾ ਸੀ ਮੰਗਵਾਇਆ ਸੀ ਜੋ ਮੈਨੂੰ ਮਾਰਕਿਟ ਦੇ ਵਿੱਚ ਨਹੀਂ ਮਿਲਿਆ ਇਸ ਕਰਕੇ ਮੈਂ ਤੁਹਾਡੇ ਐਪ ਤੋਂ ਮੰਗਵਾਇਆ ਸੀ ਐਪ ਤੋਂ ਮੰਗਵਾਇਆ ਸੀ ਜਿਸ ਦਾ ਕਲਰ ਵੀ ਚੇਂਜ ਚੇਂਜ ਹੈ ਵੋਸ਼ ਕੀਤਿਆਂ ਵੀ ਖ਼ਰਾਬ ਹੋ ਗਿਆ ਅਤੇ ਸਲੀਵਲੈੱਸ ਵੀ ਆਇਆ ਸੀ ਮੈਂ ਪਹਿਲਾਂ ਵੀ ਕੁੱਝ ਮੰਗਵਾਇਆ ਸੀ ਉਹ ਪ੍ਰੋਡਕਟ ਚੰਗਾ ਨਿਕਲਿਆ ਪਰ ਹੁਣ ਇਸ ਵਾਰ ਇਹ ਇਹ ਨਹੀਂ ਚੰਗਾ ਨਿਕ ਇਹ ਕੁੜਤਾ ਨਹੀਂ ਚੰਗਾ ਨਿਕਲਿਆ ਇਸ ਕਰਕੇ ਵਧੀਆ ਚੀਜ਼ਾਂ ਭੇਹ ਭੇਜੋ ਨਹੀਂ ਤਾਂ ਤੁਹਾਡਾ ਮਾਰਕਿਟ ਤੁਹਾਡਾ ਰਿਕੋਰਡ ਖ਼ਰਾਬ ਹੈ ਇਸ ਕਰਕੇ ਕੋਈ ਵੀ ਤੁਹਾਡੀਆਂ ਚੀਜ਼ਾਂ ਨਹੀਂ ਲਵੇਗਾ ਅੱਗੇ ਤੋਂ ਅਤੇ ਹੁਣ ਇਸ ਇਸ ਪ੍ਰੋਡਕਟ ਨੂੰ ਤਾਂ ਮੈਂ ਰੱਖ ਲਿਆ ਸੀ ਪਰ ਅੱਗੇ ਤੋਂ ਨਹੀਂ ਰੱਖਾਂਗੀ ਇਸ ਕਰਕੇ ਅੱਗੇ ਤੋਂ ਵਧੀਆ ਚੀਜ਼ਾਂ ਭੇਜੋਗੇ